ਮੈਂ ਜਦੋਂ ਰੇਲ 'ਚ ਯਾਤਰਾ ਕਰਨ ਗਈ ਤਾਂ ਮੈਨੂੰ ਬਹੁਤ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਨਾ ਹੀ ਉੱਥੇ ਸਫਾਈ ਸੀ ਨਾ ਹੀ ਉੱਥੇ ਵੋਸ਼ਰੂਮ ਵੀ ਇੰਨੇ ਗੰਦੇ ਸੀ ਟੋਇਲਟ 'ਚ ਇੰਨੇ ਗੰਦੇ ਸੀ ਉੱਥੇ ਅੰਦਰ ਜਾਣ ਨੂੰ ਸਾਡਾ ਮਨ ਹੀ ਨਹੀਂ ਕਰਦਾ ਸੀ ਨਾ ਬੈਠਣ ਦਾ ਕੋਈ ਪ੍ਰਬੰਧ ਸੀ ਫਿਰ ਮੈਂ ਘਰ ਆ ਕੇ ਆਈ ਆਰ ਟੀ ਸੀ ਟੀ ਸੀ ਗਾਹਕ ਸੇਵਾ ਨੂੰ ਕਾਲ ਕੀਤੀ ਅਤੇ ਉਹਨਾਂ ਨੂੰ ਇਹਨਾਂ ਮੁਸ਼ਕਿਲਾਂ ਦਾ ਦੱਸਿਆ ਅਤੇ ਤੁਹਾਨੂੰ ਕਿਹਾ ਇਹਨਾਂ ਦਾ ਸੁਧਾਰ ਕਰੋ ਜੇ ਨਾ ਇਹਨਾਂ 'ਚ ਸੁਧਾਰ ਨਹੀਂ ਕਰਨਗੇ ਤਾਂ ਮੈਂ ਰੇਲ ਮੰਤਰੀ ਨੂੰ ਦੱਸਾਂਗੀ ਉਹਨਾਂ ਨੂੰ ਐਪ ਅਰਜ਼ੀ ਪਾਵਾਂਗੀ